ਪੰਜਾਬ ਵਿੱਚ ਅਜਿਹੀਆਂ ਬਹੁਤ ਹੀ ਪ੍ਰਮੁੱਖ ਯੂਨੀਵਰਸਿਟੀਆਂ ਹਨ ਜਿਵੇਂ ਕਿ ਚੰਡੀਗੜ੍ਹ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਇਹਨਾਂ ਦੇ ਅੰਡਰ ਬਹੁਤ ਸਾਰੇ ਕੋਲਜਿਸ ਵੀ ਹਨ ਜਿਵੇਂ ਕਿ ਅੰਮ੍ਰਿਤਸਰ ਕੋਲਜ ਆਫ ਗਰੁੱਪ ਆਫ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਗਲੋਬਲ ਯੂਨੀਵਰਸਿਟੀ ਐਂਡ ਬੀ ਬੀ ਕੇ ਡੀ ਏ ਵੀ ਕੋਲਜ ਹਿੰਦੂ ਸਭਾ ਕੋਲਜ ਬਹੁਤ ਸਾਰੇ ਇੱਦਾਂ ਦੇ ਕੋਲਜਿਸ ਅਤੇ ਯੂਨੀਵਰਸਿਟੀਜ਼ ਹਨ ਜੋ ਬਹੁਤ ਉੱਚ ਸਿੱਖਿਆ ਪ੍ਰਦਾਨ ਕਰਦੀਆਂ ਹਨ ਚਿਤਕਾਰਾ ਯੂਨੀਵਰਸਿਟੀ ਵੀ ਹੈਗੀ ਹੈ ਜਿਹਦੇ ਵਿੱਚ ਤੁਸੀਂ ਲੋਕ ਬੇਸਿਕਲੀ ਇੰਜੀਨੀਰਿੰਗ ਦੇ ਤੌਰ 'ਤੇ ਜਾਂਦੇ ਹਨ ਪੀ ਵੀ ਕੇ ਡੀ ਏ ਵੀ ਕੋਲਜ ਜੋ ਕਿ ਜੀ ਐੱਨ ਯੂ ਦੇ ਅੰਦਰ ਆਉਂਦਾ ਹੈ ਉੱਥੇ ਇੱਕ ਅਜਿਹਾ ਕੋਰਸ ਹੈ ਬੀ ਡਿਜ਼ਾਈਨ ਮਲਟੀਮੀਡੀਆ ਜਿਸ ਨਾਲ ਤੁਸੀਂ ਡਿਜ਼ਾਇਨਿੰਗ ਲਾਈਨ ਵਿੱਚ ਅੱਗੇ ਵੱਧ ਸਕਦੇ ਹੋ ਅਤੇ ਉਹ ਕੋਰਸ ਪੂਰੇ ਅੰਮ੍ਰਿਤਸਰ ਵਿੱਚ ਸਿਰਫ਼ ਉਸੀ ਕੋਲਜ ਵਿੱਚ ਹੈਗਾ ਹੈ ਜੋ ਕਿ ਕੁੜੀਆਂ ਦੇ ਲਈ ਬਹੁਤ ਉਪਲਬਧ ਹੈ ਅਤੇ ਉੱਥੇ ਕੁੜੀਆਂ ਨੂੰ ਬਹੁਤ ਚੰਗਾ ਸਿਖਾਇਆ ਜਾਂਦਾ ਹੈ ਜਿਸ ਦਾ ਅੱਜ ਦੀ ਦੁਨੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਭਾਵ ਹੈ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਬਹੁਤ ਅਜਿਹੀਆਂ ਕੋਰਸਿਸ ਹੈਗੇ ਹਨ ਜੋ ਲੋਕਾਂ ਨੂੰ ਬਹੁਤ ਲਾਭ ਦਿੰਦੇ ਹਨ ਜਿਵੇਂ ਕਿ ਬੀ ਸੀ ਏ ਐੱਮ ਸੀ ਏ ਬੀ ਟੈਕ ਐੱਮ ਟੈਕ ਬੀ ਬੀ ਏ ਹੈ ਬੀ ਫਾਰਮੇਸੀ ਹੈ ਅਜਿਹੇ ਹੋਰ ਇੱਦਾਂ ਦੇ ਕੋਰਸਿਸ ਹੈਗੇ ਹਨ ਜੋ ਲੋਕਾਂ ਨੂੰ ਬਹੁਤ ਹੀ ਆਪਣੇ ਕਰੀਅਰ ਵੱਲ ਅੱਗੇ ਵੱਧਣ ਲਈ ਸਫ਼ਲਤਾ ਦਾ ਰਾਹ ਵਿਖਾਉਂਦੇ ਹਨ ਉਹ ਇਸ ਵਿੱਚ ਆ ਕੇ ਉਹ ਇਨ ਕੋਲਜਿਜ ਵਿੱਚ ਪੜ੍ਹ ਕੇ ਆਪਣੇ ਆਪ ਨੂੰ ਇੱਕ ਅਜਿਹੇ ਕਾਬਿਲ ਬਣਾ ਸਕਦੇ ਹਨ ਕਿ ਉਹ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਉੱਚ ਜਗ੍ਹਾ 'ਤੇ ਕੰਮ ਕਰ ਸਕਣ ਅਤੇ ਇਸ ਵਿੱਚ ਬਹੁਤ ਹੀ ਉਚੇਰੀ ਸਿੱਖਿਆ ਦਿੱਤੀ ਜਾਂਦੀ ਹੈ ਜਿਵੇਂ ਕਿ ਐਗਰੀਕਲਚਰ ਦੇ ਰਿਲੇਟਿਡ ਆਲਸੋ ਬੀ ਕੋਮ ਹੈ ਬੀ ਟੈਕ ਐੱਮ ਟੈਕ ਬੀ ਸੀ ਏ ਹੈ ਬੀ ਬੀ ਏ